ਅਗਰ ਯਾਤਰਾ ਦੀ ਗੱਲ ਕੀਤੀ ਜਾਵੇ ਤਾਂ ਮੈਂ ਬਹੁਤ ਸਾਰੀਆਂ ਥਾਵਾਂ 'ਤੇ ਘੁੰਮ ਚੁੱਕੀ ਹਾਂ ਇਹਨਾਂ ਵਿੱਚੋਂ ਅਗਰ ਮੈਂ ਕਿਸੇ ਆਪਣੇ ਸਭ ਤੋਂ ਵਧੀਆ ਜਾਂ ਆਲੀਸ਼ਾਨ ਯਾਤਰਾ ਦੀ ਗੱਲ ਕਰਾਂ ਤਾਂ ਉਹ ਇੱਕ ਸਾਡਾ ਕੋਲਜ ਫਰੈਂਡ ਦਾ ਹੀ ਟ੍ਰਿਪਸ ਬਣਿਆ ਸੀ ਜਿਹੜੇ ਜਿਹਦੇ ਵਿੱਚ ਅਸੀਂ ਡਲਹੋਜ਼ੀ ਗਏ ਹੋਏ ਸੀ ਜਿਹੜਾ ਕਿ ਸਭ ਤੋਂ ਆਲੀਸ਼ਾਨ ਯਾਤਰਾ ਸੀ ਇੱਕ ਤਾਂ ਉਹ ਆਲੀਸ਼ਾਨ ਇਸ ਤਰੀਕੇ ਨਾਲ ਸੀ ਕੀ ਮੈਂ ਆਪਣੇ ਦੋਸਤਾਂ ਨਾਲ ਗਈ ਹੋਈ ਸੀ ਸਾਡੇ ਦੋਸਤਾਂ ਦਾ ਸੱਤ ਜਣਿਆਂ ਦਾ ਗਰੁੱਪ ਸੀ ਜੋ ਅਸੀਂ ਗਏ ਹੋਏ ਸੀ ਉੱਥੇ ਅਸੀਂ ਕਾਫੀ ਇੰਨਜੋਏ ਕੀਤਾ ਕਾਫੀ ਘੁੰਮੇ ਫਿਰੇ ਇੱਕ ਉੱਥੇ ਸਭ ਤੋਂ ਜ਼ਿਆਦਾ ਮੇਨ ਆਨੰਦਮਈ ਮਹਿਸੂਸ ਇਸ ਗੱਲ ਕਰਕੇ ਹੋਇਆ ਕਿ ਉੱਥੇ ਦਾ ਜੋ ਮੌਸਮ ਹੈ ਉੱਥੇ ਦਾ ਜੋ ਵਿਊ ਹੈ ਉੱਥੇ ਦਾ ਜੋ ਪਹਾੜਾਂ ਦਾ ਪਹਾੜਾਂ ਨੂੰ ਅਸੀਂ ਦੇਖਦੇ ਹਾਂ ਉੱਥੇ ਦਾ ਜੋ ਮੌਸਮ ਹੈ ਬਹੁਤ ਹੀ ਵਧੀਆ ਸੀ ਬਹੁਤ ਹੀ ਜ਼ਿਆਦਾ ਵਧੀਆ ਜਦੋਂ ਕਿ ਪੰਜਾਬ ਵਿੱਚ ਕਾਫੀ ਗਰਮੀ ਸੀ ਪਰ ਜਦੋਂ ਅਸੀਂ ਉੱਥੇ ਗਏ ਉੱਥੇ ਕਾਫੀ ਠੰਡਾ ਮੌਸਮ ਸੀ ਜਿਸ ਨਾਲ ਸਾਨੂੰ ਬਹੁਤ ਹੀ ਆਨੰਦਮਈ ਮਹਿਸੂਸ ਹੋਇਆ ਕਿ ਅਸੀਂ ਠੰਡੇ ਇਲਾਕੇ ਵਿੱਚ ਆਏ ਹਾਂ ਜਿਸ ਕਾਰਨ ਸਾਨੂੰ ਘੁੰਮਣ ਫਿਰਨ ਵਿੱਚ ਵੀ ਕਾਫੀ ਮਜ਼ਾ ਆਇਆ ਉੱਥੇ ਦੋਸਤਾਂ ਕਰਕੇ ਸਾਨੂੰ ਹੋਰ ਵੀ ਮੈਨੂੰ ਮਜ਼ਾ ਆ ਰਿਹਾ ਸੀ ਕਿ ਹਾਂ ਮੈਂ ਆਪਣੇ ਦੋਸਤਾਂ ਨਾਲ ਗਈ ਹਾਂ ਅਸੀਂ ਕਾਫੀ ਉੱਥੇ ਅਨ ਆਨੰਦ ਮਾਣਿਆ ਕਾਫੀ ਘੁੰਮੇ ਫਿਰੇ ਉਸ ਉਹ ਟੂਰ ਮੈਨੂੰ ਆਪਣੀ ਸਭ ਤੋਂ ਜ਼ਿਆਦਾ ਆਲੀਸ਼ਾਨ 'ਤੇ ਸਭ ਤੋਂ ਜ਼ਿਆਦਾ ਵਧੀਆ ਟੂਰ ਲੱਗਾ ਅੱਜ ਤੱਕ ਦਾ ਜਿੰਨੇ ਵੀ ਮੈਂ ਟੂਰ 'ਤੇ ਗਈ ਹਾਂ ਸਭ ਤੋਂ ਜ਼ਿਆਦਾ ਆਲੀਸ਼ਾਨ ਟੂਰ ਮੈਨੂੰ ਡਲਹੋਜ਼ੀ ਦਾ ਲੱਗਿਆ